ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਆਪਣੇ ਸਮਾਜ ਵਿੱਚ ਵੱਖ ਵੱਖ ਧਰਮਾਂ ਜਾਤਾਂ ਦੇ ਲੋਕ ਰਹਿੰਦੇ ਆ ਅਤੇ ਆਪਣੇ ਜਿਵੇਂ ਕਿ ਪੰਜਾਬੀਆਂ ਦੀ ਗੱਲ ਕਰ ਲਈਏ ਜਿਹੜੇ ਪੰਜਾਬੀ ਲੋਕ ਹੁੰਦੇ ਆ ਉਹ ਪੰਜਾਬੀ ਔਰਤਾਂ ਜਿਹੜੀਆਂ ਵਾ ਉਹ ਸਲਵਾਰ ਕਮੀਜ਼ ਦੀਆਂ ਜ਼ਿਆਦਾ ਸ਼ੌਕੀਨ ਹੁੰਦੀਆਂ ਵਾ ਅਤੇ ਜਿਹੜੇ ਮਰਦ ਹੁੰਦੇ ਆ ਉਹ ਜਿਹੜੇ ਆ ਉਹ ਪਜਾਮਾ ਕੁੜਤਾ ਪਹਿਨਦੇ ਆ ਜੇ ਰੋ ਜਿਵੇਂ ਕਿ ਜਦੋਂ ਵਿਆਹ ਹੁੰਦਾ ਵਾ ਤਾਂ ਉਦੋਂ ਉਦੋਂ ਔਰਤਾਂ ਜਿਹੜੀਆਂ ਵਾ ਪੰਜਾਬੀ ਮਤਲਬ ਕਿ ਸਲਵਾਰ ਹੋ ਗਿਆ ਮਤਲਬ ਨਾਲ਼ ਧੋਤੀ ਵੀ ਪਹਿਨ ਲੈਂਦੀਆਂ ਅਤੇ ਜਿਹੜੇ ਮਰਦ ਹੁੰਦੇ ਆ ਉਹ ਪੈਂਟ ਕੋਟ ਦੀ ਵਰਤੋਂ ਕਰਦੇ ਆ ਇਵੇਂ ਹੀ ਜੇਕਰ ਆਪਾਂ ਮਤਲਬ ਕਿ ਕ ਉਹਨਾਂ ਦੀ ਗਹਿਣਿਆਂ ਦੀ ਗੱਲ ਕਰੀਏ ਤਾਂ ਜਿਹੜੀਆਂ ਵਾ ਪੰਜਾਬੀ ਪੰਜਾਬੀ ਔਰਤਾਂ ਵਾਂ ਉਹ ਜਿਹੜੀਆਂ ਵਾ ਹਾਰ ਹੋ ਗਿਆ ਆਪਣੀ ਸੁੰਦਰਤਾ ਵਧਾਉਣ ਦੇ ਲਈ ਟਿੱਕਾ ਲਾਉਂਦੀਆਂ ਵਾਂ ਕੰਨਾਂ ਦੇ ਵਿੱਚ ਡੰਡੀਆਂ ਦੀ ਵਰਤੋਂ ਕਰਦੀਆਂ ਵਾ ਅਤੇ ਮਰਦ ਜਿਹੜੇ ਆ ਉਹ ਮਤਲਬ ਕਿ ਕੜਾ ਹੋ ਗਿਆ ਮੁੰਦਰੀਆਂ ਹੋ ਗਈਆਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਆ ਇਵੇਂ ਹੀ ਜੇਕਰ ਆਪਾਂ ਦੂਜੇ ਵੱਖ ਵੱਖ ਭਾਈਚਾਰਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਰੇ ਧਰਮਾਂ ਦੇ ਲੋਕ ਆ ਅਤੇ ਜਿਹੜੇ ਹਿੰਦੂ ਹਿੰਦੂ ਔਰਤਾਂ ਹੁੰਦੀਆਂ ਵਾਂ ਉਹ ਸਾੜੀ ਪਹਿਨਣਾ ਪਸੰਦ ਕਰਦੀਆਂ ਵਾਂ ਅਤੇ ਜਿਹੜੇ ਮਰਦ ਹੈ ਉਹ ਪਜਾਮਾ ਕੁੜਤਾ ਵੀ ਪਹਿਨ ਲੈਂਦੇ ਆ ਕੁੜਤਾ ਧੋਤੀ ਵੀ ਪਹਿਨ ਲੈਂਦੇ ਆ ਅਤੇ ਇਸ ਤਰ੍ਹਾਂ ਹੀ ਜੇਕਰ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਅਤੇ ਉਹ ਔਰਤਾਂ ਜਿਹੜੀਆਂ ਵਾ ਜ਼ਿਆਦਾ ਬੁਰਕੇ ਦੇ ਵਿੱਚ ਰਹਿਣਾ ਪਸੰਦ ਕਰਦੀਆਂ ਵਾਂ ਅਤੇ ਜਿਹੜੇ ਮਰਦ ਹੁੰਦੇ ਆ ਮੁਸਲਮਾਨ ਹੁੰਦੇ ਆ ਉਹ ਲੰਮਾ ਕੁੜਤਾ ਅਤੇ ਨਾਲ਼ ਪਜਾਮਾ ਪਹਿਨਦੇ ਆ